ਮੈਨੂੰ ਬਚਪਨ ਤੋਂ ਹੀ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਕ ਸੀ ਪਰ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਘੱਟ ਆਉਂਦਾ ਸੀ ਮੇਰੇ ਕੋਲ ਚਿੱਤਰਕਾਰੀ ਕਰਨ ਲਈ ਕੋਈ ਸ੍ਰੋਤ ਅਤੇ ਕੋਈ ਗੁਰੂੂ ਹੀ ਨਹੀਂ ਸੀ ਤਾਂ ਇਸ ਸ਼ੌਕ ਨੂੰ ਪੂਰਾ ਕਰਨ ਲਈ ਮੈਂ ਅੱਜ ਤੋਂ ਦੋ ਸਾਲ ਪਹਿਲਾਂ ਡਰਾਇੰਗ ਦੀਆਂ ਚਿੱਤਰਕਾਰੀ ਦੀਆਂ ਕਲਾਸਸ ਲਗਾਉਣੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਚਿੱਤਰਕਾਰੀ ਦੇ ਵਿੱਚ ਰੁਚੀ ਹੋਰ ਵਧ ਗਈ ਇਸ ਨੂੰ ਨਿਖਾਰਨ ਲਈ ਮੈਂ ਵੱਧ ਤੋਂ ਵੱਧ ਪ੍ਰੈਕਟਿਸ ਕੀਤੀ ਅਤੇ ਹੁਣ ਮੈਂ ਯੂਟਿਊਬ ਉਤੋਂ ਔਨਲਾਈਨ ਵੀਡੀਓਸ ਦੇਖ ਕੇ ਚਿੱਤਰਕਾਰੀ ਨੂੰ ਨਿਖਾਰਦਾ ਹਾਂ ਮੋਨਾਲਿਸਾ ਜੋ ਕਿ ਦਾ ਵਿੰਚੀ ਦੁਆਰਾ ਬਣਾਈ ਗਈ ਪਿਚਰ ਹੈ ਉਹ ਮੈਨੂੰ ਬਹੁਤ ਐਨਸਪਾਇਰ ਕਰਦੀ ਹੈ ਮੈਂ ਉਸਨੂੰ ਦੀਆਂ ਬਾਰੀਕੀਆਂ ਨੂੰ ਦੇਖਦਾ ਹਾਂ ਅਤੇ ਉਸ ਨੂੰ ਸਮਝਦਾ ਹਾਂ ਚਿੱਤਰਕਾਰੀ ਕਰਨਾ ਹੁਣ ਮੇਰਾ ਬਹੁਤ ਹੀ ਪੈਸ਼ਨ ਪੈਸ਼ਨ ਬਣ ਗਿਆ ਹੈ ਚਿਤ ਮੈਂ ਇਸਨੂੰ ਨਿਖਾਰਨ ਦੇ ਲਈ ਹਰ ਰੋਜ਼ ਤਿੰਨ ਤੋਂ ਚਾਰ ਘੰਟੇ ਪ੍ਰੈਕਟਿਸ ਕਰਦਾ ਹਾਂ ਅਤੇ ਆਪਣੀਆਂ ਖਾਮੀਆਂ ਨੂੰ ਦੂਰ ਕਰਦਾ ਹਾਂ